ਅੱਜ ਦੇ ਮੁਕਾਬਲੇ 'ਚ ਸਾਡੇ ਖੇਤਰ ਵਿੱਚ ਸਿਹਤ ਸੰਭਾਲ ਦੇ ਗੁਣਵੱਤਾ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਪਹਿਲਾਂ ਲੋਕਾਂ ਲਈ ਕੋਈ ਵੀ ਇਲਾਜ ਦਾ ਕੋਈ ਵੀ ਇਲਾਜ ਨਹੀਂ ਸੀ ਹੁੰਦਾ ਅਤੇ ਹੁਣ ਹਸਪਤਾਲਾਂ ਦੇ ਹੋਣ ਕਾਰਨ ਬਹੁਤ ਹੀ ਜ਼ਿਆਦਾ ਇਲਾਜ ਹੋਣ ਲੱਗ ਗਏ ਅਤੇ ਪਿੰਡਾਂ ਵਿੱਚ ਵੀ ਬਹੁਤ ਬਹੁਤ ਪਿੰਡਾਂ ਵਿੱਚ ਵੀ ਹਸਪਤਾਲ ਜਿਹੜੇ ਉਹ ਖੁੱਲ੍ਹ ਚੁੱਕੇ ਨੇ ਅਤੇ ਵਧੀਆ ਹੀ ਇਲਾਜ ਹੁੰਦੇ ਨੇ ਅਤੇ ਸ਼ਹਿਰਾਂ ਵਿੱਚ ਵੀ ਚਾ ਵੱਧ ਤੋਂ ਵੱਧ ਹਸਪਤਾਲ ਖੁੱਲ੍ਹ ਗਏ ਨੇ ਜੋ ਕਿ ਤੁਸੀਂ ਜਲਦੀ ਮਤਲਬ ਕਿ ਇਲਾਜ ਕਰਦੇ ਨੇ ਅਤੇ ਵੱਧ ਤੋਂ ਵੱਧ ਲੋਕ ਜੋ ਕਿ ਬਿਮਾਰੀਆਂ ਤੋਂ ਬਚਦੇ ਨੇ ਅਤੇ ਲੋਕਾਂ ਦੀ ਸਿਹਤ ਵੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਮਤਲਬ ਕਿ ਪਿੰਡਾਂ ਵਿੱਚ ਜ਼ਿਆਦਾਤਰ ਐਮ ਸ਼ਹਿਰਾਂ ਵਿੱਚ ਹਸਪਤਾਲਾਂ ਵਿੱਚ ਅੰਬੁਲੈਂਸਾ ਵੀ ਹੁੰਦੀਆਂ ਨੇ ਅਤੇ ਜੋ ਜਲਦੀ ਤੋਂ ਜਲਦੀ ਪਹੁੰਚ ਜਾਂਦੀਆਂ ਨੇ ਅਤੇ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸ ਹੋਸਪੀਟਲ ਵਿੱਚ ਦਾਖਲ ਕਰਾ ਦਿੰਦੀਆਂ ਨੇ ਅਤੇ ਫਿਰ ਸ਼ਹਿਰਾਂ ਵਾਲੀਆਂ ਬਹੁਤ ਹੀ ਜ਼ਿਆਦਾ ਸਲੋ ਚੱਲਦੇ ਪਿੰਡਾਂ ਵਾਲੀਆਂ ਬਹੁਤ ਹੀ ਜ਼ਿਆਦਾ ਸਲੋਅ ਚੱਲਦੀਆਂ ਨੇ ਜੋ ਕਿ ਹੌਲੀ ਹੌਲੀ ਬੰਦੇ ਦੇ ਮਾਰਨ ਤੱਕ ਕੀ ਹੋ ਜਾਂਦਾ ਅਤੇ ਪਰ ਅੰਬੁਲੈਂਸਾ ਨਹੀਂ ਪਹੁੰਚਦੀਆਂ ਤਾਂ ਕਰਕੇ ਸ਼ਹਿਰਾਂ ਵਿੱਚ ਜ਼ਿਆਦਾ ਹੁੰਦੀਆਂ ਨੇ ਅਤੇ ਪਿੰਡਾਂ ਵਿੱਚ ਘੱਟ ਅਤੇ ਇਸ ਜ਼ਿਆਦਾਤਰ ਲੋਕ ਸ਼ਹਿਰਾਂ ਵਿੱਚ ਹੀ ਆਪਣਾ ਇਲਾਜ ਕਰਵਾਉਂਦੇ ਹਨ ਇਸ ਲਈ ਸਹੂਲਤਾਂ ਤਾਂ ਸ਼ਹਿਰਾਂ ਵਿੱਚ ਹੀ ਮਿਲਦੀਆਂ ਨੇ ਅਤੇ ਜ਼ਿਆਦਾਤਰ ਘੱਟ ਪੈਸਿਆਂ ਤੇ ਇਲਾਜ ਹੋ ਜਾਂਦਾ ਹੈ